ਹੈਲੋ ਕੀ ਮੇਰੀ ਜਗਦੀਸ਼ ਟਰੈਵਲ ਅਜੈਂਸੀ ਨਾਲ ਗੱਲ ਹੋ ਰਹੀ ਹੈ ਮੈਂ ਇੱਕ ਰੇਲ ਯਾਤਰਾ ਕਰਨੀ ਚਾਹੁੰਦਾ ਹਾਂ ਅਤੇ ਇਸ ਲਈ ਤੁਹਾਡੇ ਮਾਰਗ ਦਰਸ਼ਨ ਅਤੇ ਸਹਾਇਤਾ ਦੀ ਲੋੜ ਹੈ ਮੈਂ ਅਤੇ ਮੇਰੇ ਕੁਝ ਮਿੱਤਰ ਚੰਡੀਗੜ੍ਹ ਤੋਂ ਗੋਆ ਰੇਲ ਰਾਹੀਂ ਯਾਤਰਾ ਕਰਨੀ ਚਾਹੁੰਦੇ ਹਾਂ ਅਤੇ ਇਸ ਯਾਤਰਾ ਨੂੰ ਮਜ਼ੇਦਾਰ ਬਣਾਉਣ ਵਿੱਚ ਤੁਹਾਡੀ ਮਦਦ ਚਾਹੁੰਦੇ ਹਾਂ ਸਾਡਾ ਇਹ ਪ੍ਰੋਗਰਾਮ ਸੱਤ ਦਿਨਾਂ ਦਾ ਹੈ ਅਸੀਂ ਮਿਤੀ ਚੌਵੀ ਨੌਂ ਦੋ ਹਜ਼ਾਰ ਚੌਵੀ ਨੂੰ ਚੰਡੀਗੜ੍ਹ ਤੋਂ ਗੋਆ ਜਾਣ ਲਈ ਰੇਲ ਵਿੱਚ ਸਫ਼ਰ ਕਰਨਾ ਚਾਹੁੰਦੇ ਹਾਂ ਅਤੇ ਮਿਤੀ ਤੀਹ ਸਤੰਬਰ ਦੋ ਹਜ਼ਾਰ ਚੌਵੀ ਨੂੰ ਗੋਆ ਤੋਂ ਵਾਪਸ ਚੰਡੀਗੜ੍ਹ ਟਰੇਨ ਰਾਹੀਂ ਆਉਣਾ ਚਾਹੁੰਦੇ ਹਾਂ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਸ ਰੂਟ 'ਤੇ ਕਿਹੜੀਆਂ ਕਿਹੜੀਆਂ ਟ੍ਰੇਨਾਂ ਉਪਲਬਧ ਹਨ ਸਾਡੇ ਲਈ ਇਸ ਯਾਤਰਾ ਦੌਰਾਨ ਕਿਹੜੀ ਟਰੇਨ ਵਧੀਆ ਰਹੇਗੀ ਉਸਦਾ ਚੰਡੀਗੜ੍ਹ ਤੋਂ ਚੱਲਣ ਦਾ ਸਮਾਂ ਕੀ ਹੈ ਅਤੇ ਰਸਤੇ ਵਿੱਚ ਕਿਹੜੇ ਕਿਹੜੇ ਸਟੋਪੇਜ ਆਉਂਦੇ ਹਨ ਨਾਲ ਹੀ ਸਾਨੂੰ ਗੋਆ ਤੋਂ ਵਾਪਸ ਚੰਡੀਗੜ੍ਹ ਆਉਣ ਲਈ ਟਰੇਨ ਜੋ ਸੂਟ ਕਰਦੀ ਹੈ ਉਹ ਵੀ ਦੱਸੀ ਜਾਵੇ ਅਤੇ ਉਸਦਾ ਟੈਮ ਟੇਬਲ ਕੀ ਰਹੇਗਾ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਟਰੇਨ ਵਿੱਚ ਰਿ ਰਿਜਰਵੇਸ਼ਨ ਕਿਸ ਤਰ੍ਹਾਂ ਕਰਵਾਉਣੀ ਹੈ ਇਸ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਜਾਵੇ ਰਿਜਰਵੇਸ਼ਨ ਕਰਵਾਉਣ ਲਈ ਕਿਹੜੇ ਕਿਹੜੇ ਡਾਕੂਮੈਂਟਸ ਲੋੜੀਂਦੇ ਹਨ ਇਸ ਬਾਰੇ ਮੈਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ ਰੇਲ ਸਫ਼ਰ ਦੌਰਾਨ ਕੀ ਸਾਨੂੰ ਖਾਣਾ ਵੀ ਉਪਲਬਧ ਕਰਵਾਇਆ ਜਾਵੇਗਾ ਇਸ ਬਾਰੇ ਵੀ ਦੱਸਿਆ ਜਾਵੇ ਟਰੇਨ ਵਿੱਚ ਅਲੱਗ ਅਲੱਗ ਸ਼੍ਰੇਣੀਆਂ ਦਾ ਕੀ ਕਿਰਾਇਆ ਹੋਵੇਗਾ ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ ਜਾਵੇ ਕਿਰਪਾ ਕਰਕੇ ਮੈਨੂੰ ਮੇਰੀ ਯਾਤਰਾ ਦੇ ਪੂਰੇ ਪ੍ਰੋਗਰਾਮ ਦਾ ਤੁਸੀਂ ਮਾਰਗ ਦਰਸ਼ਨ ਕਰਨਾ ਹੈ ਅਤੇ ਇਸਨੂੰ ਇੱਕ ਮਜ਼ੇਦਾਰ ਯਾਤਰਾ ਬਣਾਉਣ ਵਿੱਚ ਤੁਸੀਂ ਮੇਰੀ ਪੂਰੀ ਸਹਾਇਤਾ ਕਰਨੀ ਹੈ ਤੁਹਾਡੇ ਜਵਾਬ ਦੀ ਉਡੀਕ ਵਿੱਚ